ਹੈਲੋ ਮੇਰਾ ਨਾਂ ਮਨਪ੍ਰੀਤ ਸਿੰਘ ਹੈ ਮੈਂ ਅੱਜ ਨਾਗਰਿਕਾਂ ਲਈ ਬੈਂਕਿੰਗ ਨੂੰ ਸੌਖਾ ਬਣਾਉਣ ਲਈ ਬੈਂਕਿੰਗ ਬਾਰੇ ਕੁਝ ਜੋ ਵਾ ਦੱਸਣ ਜਾ ਰਿਹਾ ਹਾਂ ਜੋ ਕਿ ਅਸੀਂ ਜਿਵੇਂ ਕਿ ਬੈਂਕਿੰਗ ਨੂੰ ਸੌਖਾ ਬਣਾਉਣ ਲਈ ਸਰਕਾਰ ਨੇ ਨਵੀਆਂ ਯੋਜਨਾਵਾਂ ਬਣਾਈਆਂ ਹਨ ਜਿਵੇਂ ਕਿ ਫੋਨਪੇਅ ਗੂਗਲ ਪੇਅ ਅਤੇ ਪੇਟੀਐਮ ਇਸ ਨਾਲ ਅਸੀਂ ਆਪਣੇ ਘੱਟ ਸਮੇਂ ਦਾ ਬਚਾਅ ਕਰਨ ਲਈ ਛੇਤੀ ਤੋਂ ਛੇਤੀ ਆਪਣਾ ਕੋਈ ਵੀ ਕੰਮ ਕਰ ਸਕਦੇ ਹਾਂ ਅਤੇ ਸਾਨੂੰ ਬੈਂਕਿੰਗ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਸਾਨੂੰ ਬੈਂਕ ਵਿੱਚ ਜਾਣ ਦੀ ਲੋੜ ਨਹੀਂ ਅਤੇ ਇਸ ਨਾਲ ਸਾਡਾ ਬਹੁਤ ਸਮਾਂ ਬਚਦਾ ਹੈ ਅਤੇ ਸਾਨੂੰ ਬੈਂਕਿੰਗ ਤੋਂ ਬਹੁਤ ਰਾਹਤ ਮਿਲਦੀ ਹੈ ਅਤੇ ਇਸ ਨਾਲ ਬੈਂਕ ਵਿੱਚ ਕੋਈ ਭੀੜ ਭੁਜਾਕਾ ਜਾਂ ਕੋਈ ਚੋਰੀ ਦਾ ਡਰ ਵੀ ਘੱਟ ਜਾਂਦਾ ਹੈ ਅਤੇ ਸਰਕਾਰ ਦੀ ਇਹ ਯੋਜਨਾਵਾਂ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਅਤੇ ਅਸੀਂ ਆਪਣਾ ਇਸ ਨਾਲ ਇਸ ਬੈਂਕਿੰਗ ਨਾਲ ਅਸੀਂ ਆਪਣਾ ਔਨਲਾਈਨ ਕੰਮ ਵੀ ਕਰ ਸਕਦੇ ਹਾਂ ਅਤੇ ਇਸ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਅਤੇ ਇਸ ਯੋਜਨਾਵਾਂ ਯੋਜਨਾਵਾਂ ਦੇ ਲਈ ਸਰਕਾਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ